ਤੈਰਾਕੀ ਸਮੁੱਚੀ ਸਿਹਤ ਅਤੇ ਤੰਦਰੁਸਤੀ ਲਈ ਬਹੁਤ ਫਾਇਦੇਮੰਦ ਹੈ ਪੰਜਾਹ ਮੀਟਰ ਤੈਰਾਕੀ ਅਤੇ ਚਾਰ ਸੌ ਮੀਟਰ ਦੌੜ ਇੱਕ ਬਰਾਬਰ ਹਨ ਤੈਰਾਕੀ ਇੱਕੋ ਇੱਕ ਸਪੋਰਟ ਹੈ ਜਿਹਦੇ ਵਿੱਚ ਤੁਹਾਡੀ ਸਰੀਰ ਦੇ ਹਰ ਇੱਕ ਮਸਲ ਦਾ ਯੂਟੀਲਾਈਜੇਸ਼ਨ ਹੁੰਦੀ ਹੈ ਜਿਸ ਤਰੀਕੇ ਨਾਲ ਜੇ ਤੁਸੀਂ ਦੌੜਦੇ ਹੋ ਤਾਂ ਇਕੱਲੀਆਂ ਲੱਤਾਂ ਅਤੇ ਬਾਹਵਾਂ ਦਾ ਜ਼ੋਰ ਲੱਗਦਾ ਹੈ ਪਰ ਤੈਰਾਕੀ ਵਿੱਚ ਹਰ ਇੱਕ ਔਰਗਨ ਦਾ ਜ਼ੋਰ ਲੱਗਦਾ ਅਤੇ ਸਭ ਤੋਂ ਖਾਸ ਗੱਲ ਹੈ ਕਿ ਇਹ ਸਾਹ ਨਿਯੰਤਰਣ ਵਿੱਚ ਵੀ ਬੜੀ ਮਦਦ ਕਰਦਾ ਅਤੇ ਤੁਸੀਂ ਜਦੋਂ ਸਾਹ ਦੀ ਪ੍ਰਣਾਲੀ ਨੂੰ ਥੋੜ੍ਹੀ ਦੇਰ ਲਈ ਬੰਦ ਕਰ ਦਿਉ ਜਿਸ ਤਰੀਕੇ ਨਾਲ ਯੋਗਾ ਦੇ ਵਿੱਚ ਤੁਸੀਂ ਸਾਹ ਰੋਕਦੇ ਹੋ ਅਤੇ ਆਪਣੇ ਹਰ ਇੱਕ ਔਰਗਨ ਨੂੰ ਜਦੋਂ ਦੁਬਾਰਾ ਤੁਸੀਂ ਸਾਹ ਲੈਂਦੇ ਹੋ ਅਤੇ ਕਿਉਂਕਿ ਬੌਡੀ ਦੇ ਵਿੱਚੋਂ ਔਕਸੀਜਨ ਡਪਲੀਟ ਹੋਈ ਹੁੰਦੀ ਹੈ ਅਤੇ ਇੱਕਦਮ ਆਕਸੀਜਨ ਚਾਹੀਦੀ ਹੁੰਦੀ ਹੈ ਅਤੇ ਨਸਾਂ ਸਾਰੀਆਂ ਖੁੱਲ੍ਹ ਜਾਂਦੀਆਂ ਨੇ ਉਸੇ ਤਰੀਕੇ ਨਾਲ ਤੈਰਾਕੀ ਦੇ ਵਿੱਚ ਕਿਉਂਕਿ ਜਦੋਂ ਤੁਸੀਂ ਪਾਣੀ ਦੇ ਅੰਦਰ ਹੁੰਦੇ ਹੋ ਤਾਂ ਸਾਹ ਨਹੀਂ ਲੈ ਸਕਦੇ ਅਤੇ ਥੋੜ੍ਹੀ ਦੇਰ ਬਾਅਦ ਸਾਹ ਲੈਂਦੇ ਹੋ ਅਤੇ ਐਗਜੈਕਟਲੀ ਜਿੱਦਾਂ ਯੋਗਾ ਦੇ ਵਿੱਚ ਇਹਦਾ ਫਾਇਦਾ ਮਿਲਦਾ ਇਹਦੇ ਵਿੱਚ ਵੀ ਫਾਇਦਾ ਮਿਲਦਾ ਅਤੇ ਤੁਹਾਡਾ ਸਰੀਰ ਜਿਹੜਾ ਵਾ ਇਹਦੇ ਨਾਲ ਲੰਘ ਕਪੈਸਿਟੀ ਜਿਹੜੀ ਆ ਇਹਦੀ ਬਹੁਤ ਵੱਧ ਜਾਂਦੀ ਹੈ ਅਤੇ ਅੱਗੇ ਜਾ ਕੇ ਦਮੇ ਦੀ ਜਾਂ ਹੋਰ ਪ੍ਰੋਬਲਮਜ ਨਹੀਂ ਆਉਂਦੀਆਂ